ਚੁਰਾਨਵੇਂ ਸੱਤ ਸੌ ਛਿਆਸੀ ਪੰਜ ਹਜ਼ਾਰ ਚਾਰ ਸੌ ਛਪੰਜਾ ਉੱਨੀ ਹਜ਼ਾਰ ਅੱਠ ਸੌ ਚੁਰਾਨਵੇਂ ਇੱਕ ਲੱਖ ਨੱਬੇ ਹਜ਼ਾਰ ਅੱਠ ਸੌ ਚੁਰਾਨਵੇਂ